ਵੈਸੇ ਤਾਂ ਮੈਂ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ ਹਨ ਪਰ ਮੈਂ ਇੱਕ ਇੱਕ ਦਿਨ ਨੈਨਾ ਦੇਵੀ ਗਈ ਅਤੇ ਉੱਥੇ ਮੈਨੂੰ ਜਾਣ ਵਿੱਚ ਬਹੁਤ ਡਰ ਲੱਗ ਰਿਹਾ ਸੀ ਕਿਉਂਕਿ ਉੱਥੇ ਬਾਂਦਰ ਕੋਲ ਆ ਰਹੇ ਸੀ ਅਤੇ ਉਹ ਚੀਜ਼ਾਂ ਲੋਕਾਂ ਕੋਲ਼ੋਂ ਚੀਜ਼ਾਂ ਖੋਹ ਕੇ ਲੈ ਕੇ ਜਾ ਰਹੇ ਸਨ ਅਤੇ ਮੈਨੂੰ ਮਾਤਾ ਰਾਣੀ ਦੀ ਪ ਚੜ੍ਹਾਈ ਚੜ੍ਹਨ ਵਿੱਚ ਵੀ ਬਹੁਤ ਡਰ ਲੱਗ ਰਿਹਾ ਸੀ ਕਿਉਂਕਿ ਮੰਦਰ ਬਹੁਤ ਉੱਚਾ ਸੀ ਅਤੇ ਜਦੋਂ ਨੀਚੇ ਦੇਖਦਾ ਸੀ ਤਾਂ ਸਾਰਾ ਕੁਝ ਛੋਟਾ ਛੋਟਾ ਦਿਖਾਈ ਦੇ ਰਿਹਾ ਸੀ ਅਤੇ ਹ ਅਤੇ ਉਹ ਮੈਂ ਬਹੁਤ ਥੱਕ ਗਈ ਸੀ ਕਿਉਂਕਿ ਬਹੁਤ ਦੂਰ ਜਾ ਕੇ ਮੰਦਰ ਸੀ